ਸਭ ਤੋਂ ਪਹਿਲਾਂ ਵਿਅਕਤੀ ਵਿੱਚ ਚਿੱਤਰਕਾਰੀ ਕਰਨ ਦੀ ਕਲਾ ਹੋਣੀ ਚਾਹੀਦੀ ਹੈ ਉਸ ਨੂੰ ਚਿੱਤਰ ਬਣਾਉਣਾ ਅਤੇ ਚਿੱਤਰ ਛਾਪਣ ਦੀ ਕਲਾ ਬਾਰੇ ਗਿਆਨ ਹੋਣਾ ਚਾਹੀਦਾ ਹੈ ਚਿੱਤਰਕਾਰੀ ਲੋਕਾਂ ਲਈ ਉਪਚਾਰਕ ਜਾਂ ਲਾਭਕਾਰੀ ਹੋ ਸਕਦੀ ਹੈ ਇੱਕ ਕਲਾਕਾਰ ਹੋਣ ਤੋਂ ਇੱਕ ਵਿਅਕਤੀ ਵਜੋਂ ਚਿੱਤਰਕਾਰੀ ਰਾਹੀਂ ਅਨੁਸ਼ਾਸਨ ਸੰਗਠ ਸੰਗਠਨਾਤਮਕ ਹੁਨਰ ਕਲਪਨਾ ਰਚਨਾਤਮਕ ਆਦਿ ਗੁਣ ਪੈਦਾ ਹੁੰਦੇ ਹਨ ਚਿੱਤਰਕਾਰੀ ਕਰਨ ਲਈ ਵਿਅਕਤੀ ਦਾ ਮਨ ਚਿੱਤਰਕਾਰੀ ਕਰਨ ਲਈ ਵਿਅਕਤੀ ਦਾ ਮਨ ਹੋਣਾ ਚਾਹੀਦਾ ਹੈ ਉਸਨੂੰ ਚਿੱਤਰਾਂ ਨੂੰ ਛਾਪਣ ਅਤੇ ਬਣਾਉਣ ਦੀ ਸਮਝ ਹੋਣੀ ਚਾਹੀਦੀ ਹੈ